ਭਾਅ ਜੀ ਸਤਿ ਸ਼੍ਰੀ ਅਕਾਲ ਤੁਸੀਂ ਜੀ ਬਾਵਾ ਟਰੈਵਲਿੰਗ ਏਜੰਸੀ ਤੋਂ ਬੋਲ ਰਹੇ ਹੋ ਹਾਂਜੀ ਮੈਂ ਗੱਡੀ ਬੁੱਕ ਕਰਾਉਣੀ ਤੀ ਜੀ ਓ ਪਿਛਲੀ ਵਾਰ ਗੱਡੀ ਬੁੱਕ ਕਰਾਈ ਤੀ ਨਾ ਜੀ ਅਤੇ ਅਸੀਂ ਏਅਰਪੋਰਟ ਨੂੰ ਉੱਥੇ ਏਅਰਪੋਰਟ ਗਏ ਤੇ ਅਤੇ ਉਹਦਾ ਡਰਾਈਵਰ ਦਾ ਨਾਮ ਤਾ ਜਸਵਿੰਦਰ ਸਿੰਘ ਹਾਂਜੀ ਬਹੁਤ ਵਧੀਆ ਬੰਦਾ ਤਾ ਜੀ ਉਹ ਗੱਲਬਾਤ ਵੀ ਠੀਕ ਤੀ ਜੀ ਉਹਦੀ ਬੋਲ ਬਾਣੀ ਵੀ ਠੀਕ ਤੀ ਵੈਸੇ ਵੀ ਠੀਕ ਤਾ ਸੁਭਾਅ ਦਾ ਵੀ ਠੀਕ ਤਾ ਬੰਦਾ ਹਾਂਜੀ ਅਤੇ ਉਸ ਨੂੰ ਅਸੀਂ ਲੈ ਜਾਣਾ ਚਾਹੁੰਦੇ ਹਾਂ ਦੁਬਾਰਾ ਅਤੇ ਉਹ ਤੁਸੀਂ ਦੱਸੋ ਵੀ ਅਸੀਂ ਫੇਰ ਜਾਣਾ ਹੈ ਏਅਰਪੋਰਟ 'ਤੇ ਵੀ ਉਹ ਬੰਦਾ ਸਾਨੂੰ ਮਿਲ ਸਕਦਾ ਹੈ ਦੁਬਾਰਾ ਕਿ ਨਹੀਂ ਮਿਲ ਸਕਦਾ ਜੀ ਹਾਂਜੀ ਪਤਾ ਕਰਕੇ ਦੱਸੋ ਜੀ ਧੰਨਵਾਦ ਜੀ